ਜਿਹੜੇ ਸਾਡੇ ਪਿੰਡ ਦੇ ਵਿੱਚ ਅਤੇ ਸਾਡੇ ਪੰਜਾਬ ਦੇ ਵਿੱਚ ਜਾਨਵਰ ਆਉਂਦੇ ਆ ਸਾਨੂੰ ਬਹੁਤ ਪਿਆਰੇ ਅਤੇ ਬਹੁਤ ਸੋਹਣੇ ਲੱਗਦੇ ਹਨ ਸਭ ਤੋਂ ਵੱਧ ਸਾਨੂੰ ਮੋਰ ਮੋਰ ਨੂੰ ਤਾਂ ਸਭ ਹੀ ਜਾਣਦੇ ਹਨ ਮੋਰ ਪੰਛੀ ਬਹੁਤ ਵਧੀਆ ਆ ਅਤੇ ਬਹੁਤ ਸੋਹਣਾ ਲੱਗਦਾ ਜਦੋਂ ਬੋਲਦਾ ਪੈਲਾਂ ਪਾਉਂਦਾ ਅਤੇ ਤੜਕੇ ਦੁਪਹਿਰ ਅਤੇ ਤੜਕੇ ਵੀ ਜਦੋਂ ਉਹਦੀ ਬੋਲੀ ਸੁਣਦੇ ਹਾਂ ਜਾਂ ਕੋਇਲ ਦੀ ਜਾਂ ਮੋਰ ਦੀ ਅਤੇ ਬਹੁਤ ਸਾਡੇ ਮਨ ਪਸੰਦ ਹੈ ਬਹੁਤ ਪਿਆਰੇ ਜੋ ਪੰਛੀ ਆਉਂਦੇ ਹੈ ਸਾਡੇ ਘਰਾਂ ਦੇ ਵਿੱਚ ਤੋਤੇ ਗਟਿਆਰਾਂ ਕਾਂ ਅਤੇ ਅਸੀਂ ਉਹਨਾਂ ਨੂੰ ਖਾਣਾ ਵੀ ਦਿੰਦੇ ਹਾਂ ਅਤੇ ਪਾਣੀ ਵੀ ਧਰਦੇ ਹਾਂ ਅਤੇ ਆਥਣੇ ਜਦੋਂ ਉਹ ਘਰਾਂ ਨੂੰ ਜਾਂਦੇ ਆ ਉਹਨਾਂ ਦੀ ਚੀ ਚੀ ਹੁੰਦੀ ਹੈ ਚਿੜੀਆਂ ਦੀ ਅਤੇ ਉਹ ਵੀ ਸਾਡੇ ਬਹੁਤ ਮਨਪਸੰਦ ਹੈ ਅਤੇ ਜੋ ਤੜਕੇ ਦੁਪਹਿਰ ਦੇ ਤੜਕੇ ਵੀ ਚਿੜੀਆਂ ਬੋਲਦੀਆਂ ਸਾਡੇ ਕੰਨਾਂ 'ਚ ਪੈਂਦੀ ਹੈ ਅਤੇ ਸਾਨੂੰ ਸੁੱਤਿਆਂ ਨੂੰ ਜਗਾਉਂਦੀਆਂ ਚੀ ਚੀ ਕਰਦੀਆਂ ਤੜਕੇ ਪੰਜ ਵਜੇ ਆ ਕੇ ਅਤੇ ਉਹ ਵੀ ਸਾਨੂੰ ਬਹੁਤ ਪਿਆਰੀਆਂ ਅਤੇ ਸੋਹਣੀਆਂ ਲੱਗਦੀਆਂ ਜਿੰਨੇ ਵੀ ਜਾਨਵਰ ਆ ਅਤੇ ਬਹੁਤ ਵਧੀਆ ਅਤੇ ਸਾਡੇ ਮਨ ਪਸੰਦ ਆ ਮੋਰ ਅਤੇ ਮੋਰ ਜਦੋਂ ਪੈਲ ਪਾਉਂਦਾ ਸਾਰਿਆਂ ਨੂੰ ਪਤਾ ਵੀ ਬਹੁਤ ਸੋਹਣਾ ਅਤੇ ਬਹੁਤ ਸੋਹਣਾ ਬੋਲਦਾ ਅਤੇ ਬਹੁਤ ਹੀ ਸੋਹਣਾ ਜਾਨਵਰ ਹੈ ਬਹੁਤ ਪੰਛੀ ਬਾਹਲਾ ਵਧੀਆ ਸਾਰੇ ਪੰਛੀ ਬਹੁਤ ਵਧੀਆ ਸਾਰਿਆਂ ਨਾਲ ਪਿਆਰ ਹੈ ਪਰ ਸਾਰਿਆਂ ਤੋਂ ਵਧੀਆ ਸਾਨੂੰ ਕੋਇਲ ਵੀ ਵਧੀਆ ਲੱਗਦੀ ਹੈ ਅਤੇ ਮੋਰ ਵੀ ਵਧੀਆ ਲੱਗਦਾ